ਮੈਂ ਆਪਣੀ ਰਸੋਈ ਵਿੱਚ ਅੱਜ ਜੇ ਗੱਲ ਕਰਾਂ ਤਾਂ ਚੋਪਰ ਇੱਕ ਐਸੀ ਚੀਜ਼ ਹੈ ਜਿਹਦੇ ਤੋਂ ਬਗੈਰ ਜਿਹੜਾ ਮੇਰਾ ਮਤਲਬ ਕੋਈ ਵੀ ਕੰਮ ਨਹੀਂ ਹੋ ਸਕਦਾ ਮੈਨੂੰ ਹਰ ਕੰਮ ਕਰਨ ਵਾਸਤੇ ਚੋਪਰ ਦੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਕਿਉਂਕਿ ਮੈਂ ਬਹੁਤ ਜ਼ਿਆਦਾ ਉਹਦੇ 'ਤੇ ਡਿਪੈਂਡੈਂਟ ਹਾਂ ਮੈਂ ਕੋਈ ਵੀ ਪਿਆਜ ਕੱਟਣਾ ਸਬਜ਼ੀ ਕੱਟਣੀ ਹੈ ਅਤੇ ਮੈਨੂੰ ਬਹੁਤ ਜ਼ਿਆਦਾ ਉਹਦੀ ਜਿਹੜੀ ਜ਼ਰੂਰਤ ਹੈ ਮਹਿਸੂਸ ਹੁੰਦੀ ਹੈ ਹੋਰ ਵੀ ਹੈਗੇ ਨੇ ਜਿਵੇਂ ਮਿਕਸਰ ਗਰੈਂਡਰ ਦੀ ਆਪਾਂ ਕਰੀਏ ਕਿਉਂਕਿ ਅੱਜ ਕੱਲ੍ਹ ਸਹੂਲਤਾਂ ਜਿਹੜੀਆਂ ਬਹੁਤ ਵੱਧ ਰਹੀਆਂ ਨੇ ਅਤੇ ਜਿਹੜੀਆਂ ਸਾਨੂੰ ਨਵੇਂ ਨਵੇਂ ਯੰਤਰ ਮਿਲ ਰਹੇ ਨੇ ਟੂਲ ਮਿਲ ਰਹੇ ਨੇ ਉਹਨਾਂ ਨੇ ਸਾਡੇ ਜੀਵਨ ਨੂੰ ਬਹੁਤ ਜ਼ਿਆਦਾ ਜਿਹੜਾ ਉਹ ਈਜ਼ੀ ਕਰ ਦਿੱਤਾ ਵੈ ਉਹਦੇ ਵਿੱਚ ਇੱਕ ਮਾਈਕਰੋਵੇਵ ਓਵਨ ਵੀ ਮਾਈਕਰੋਵੇਵ ਵੀ ਹੈਗਾ ਵੈ ਜਿਹਦੇ ਵਿੱਚ ਆਪਾਂ ਕਦੀ ਵੀ ਆਪਣੀ ਸਬਜ਼ੀ ਨੂੰ ਗਰਮ ਕਰ ਸਕਦੇ ਹਾਂ ਹੈ ਨਾ ਕਿ ਬਈ ਆਪਾਂ ਬਣਾ ਦਿੱਤੀ ਸਬਜ਼ੀ ਸਾਨੂੰ ਬਾਰ ਬਾਰ ਗੈਸ ਚਲਾਉਣ ਦੀ ਜ਼ਰੂਰਤ ਨਹੀਂ ਹੈ ਥਟੀ ਮਿਨਟਸ ਤੱਕ ਤੀਹ ਸੈਕਿੰਡ ਜਾਂ ਵੰਨ ਮਿਨਟ ਦਾ ਤੁਸੀਂ ਟਾਈਮਰ ਲਗਾਇਆ ਅਤੇ ਉਹਦੇ ਵਿੱਚ ਉਸੀ ਟਾਈਮ ਜਿਹੜੀ ਹੈ ਉਹ ਸਬਜ਼ੀ ਗਰਮ ਹੋ ਜਾਂਦੀ ਹੈ ਅਤੇ ਮਿਕਸਰ ਗਰੈਂਡਰ ਦੀ ਗੱਲ ਕਰੀਏ ਤਾਂ ਮਿਕਸ ਗਰੈਂਡਰ ਵੀ ਜਿਹੜਾ ਉਹ ਬਹੁਤ ਜਿਹੜਾ ਏ ਇਸਤੇਮਾਲ ਵਿੱਚ ਆਉਂਦਾ ਵੈ ਅੱਜ ਕੱਲ੍ਹ ਹੋਰ ਵੀ ਬਹੁਤ ਸਾਰੇ ਆਣ ਲੱਗ ਪਏ ਨੇ ਜਿਵੇਂ ਓ ਟੀ ਜੀ ਹੁੰਦਾ ਹੈ ਉਹ ਤੰਦੂਰ ਦਾ ਕੰਮ ਜਿਹੜਾ ਉਹ ਕਰਦਾ ਵੈ ਕਿ ਬਈ ਜਿਹੜੀ ਤੰਦੂਰ ਨੂੰ ਉਹਨੇ ਰਿਪਲੇਸ ਕਰ ਦਿੱਤਾ ਹੈ ਘਰ ਹੀ ਕੁਲਚੇ ਲਗਾ ਸਕਦੇ ਹਾਂ ਤੰਦੂਰੀ ਨਾਨ ਬਣਾ ਸਕਦੇ ਹਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਘਰ ਹੀ ਬਣਾ ਸਕਦੇ ਆ ਅਤੇ ਅੱਜ ਕੱਲ੍ਹ ਜਿਹੜੀ ਸਾਇੰਸ ਹੈਗੀ ਆ ਉਹਨੇ ਬਹੁਤ ਸਾਰੀਆਂ ਤਕਨੀਕਾਂ ਸਾਨੂੰ ਦੇ ਦਿੱਤੀਆਂ ਨੇ ਜਿਹਦੇ ਨਾਲ ਸਾਡਾ ਜਿਹੜਾ ਜੀਵਨ ਹੈਗਾ ਉਹ ਬਹੁਤ ਜ਼ਿਆਦਾ ਸੁਖੇਲਾ ਹੋ ਗਿਆ ਹੈ ਅਤੇ ਜੇ ਮੈਂ ਆਪਣੀ ਗੱਲ ਕਰਾਂ ਅਤੇ ਮੇਰੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਜੇ ਕਿਚਨ 'ਚ ਕੋਈ ਚੀਜ਼ ਹੈਗੀ ਹੈ ਅਤੇ ਉਹ ਚੋਪਰ ਅਤੇ ਮਿਕਸਰ ਗਰੈਂਡਰ ਹੈ ਜਿਹਨਾਂ ਤੋਂ ਬਗੈਰ ਮੈਂ ਸੋਚਦੀ ਹਾਂ ਕਿ ਮੈਂ ਕੰਮ ਨਹੀਂ ਕਰ ਸਕਦੀ ਕਿਚਨ 'ਚ